ਹਾਂਜੀ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਭਾਸ਼ਾ ਅੰਗਰੇਜ਼ੀ ਹੈ ਜੀ ਤਾਂ ਹਿੰਦੀ ਦੁਆਰਾ ਵੀ ਪ੍ਰਭਾਵਿਤ ਨਹੀਂ ਹੋਈ ਪ੍ਰਭਾਵਿਤ ਹੋਈ ਆ ਇਹਦੇ ਵਿੱਚ ਜਿਵੇਂ ਮੰਨ ਲਉ ਆਪਾਂ ਏ ਟੀ ਐਮ ਦੇ ਵਿੱਚ ਜਾਂਦੇ ਹਾਂ ਏ ਟੀ ਐਮ ਦੇ ਵਿੱਚ ਔਪਸ਼ਨਾਂ ਪੰਜਾਬੀ ਦੀ ਕਈ ਸ ਬੈਂਕਾਂ ਕ ਮ ਮਸ਼ੀਨਾਂ ਦੇ ਵਿੱਚ ਜਿੱਦਾਂ ਪੰਜਾਬੀ ਦੀ ਔਪਸ਼ਨ ਏ ਨਹੀਂ ਆਉਂਦੀ ਹੈਗੀ ਜਿਹੜਾ ਏ ਟੀ ਐਮ ਕਾਰਡ ਹੁੰਦੇ ਆ ਉਹਨਾਂ ਵਿੱਚ ਆਉਗੀ ਇੰਗਲਿਸ਼ ਅਦਰ ਲੈਂਗੁਏਜ ਪੰਜਾਬੀ ਦਾ ਲਿਖਿਆ ਵਿਆ ਨਹੀਂ ਹੁੰਦਾ ਅਤੇ ਸਕੂਲਾਂ ਦੇ ਵਿੱਚ ਵੀ ਜਿਹੜੇ ਆਪਣੇ ਪੰਜਾਬ ਦੇ ਵਿੱਚ ਸਕੂਲ ਆ ਉਹਨਾਂ ਦੇ ਵਿੱਚ ਵੀ ਹਿੰਦੀ ਨੂੰ ਪਰੈਫਰੈਂਸ ਦਿੱਤੀ ਜਾਂਦੀ ਆ ਜਾਂ ਬੋਲੋ ਇੰਗਲਿਸ਼ ਜ਼ਿਆਦਾਤਰ ਤਾਂ ਇੰਗਲਿਸ਼ ਬੋਲਣ ਨੂੰ ਸਟੇਟਸ ਸਿੰਬਲ ਸਮਝਣ ਲੱਗ ਗਏ ਵੀ ਜਿਹੜੇ ਬੰਦੇ ਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਉਹ ਬੰਦਾ ਹੀ ਨਹੀਂ ਮੰਨਦੇ ਉਹਨੂੰ ਤਾਂ ਉਹਨੂੰ ਅਨਪੜ੍ਹ ਦਾ ਸਮੇਤ ਟੈ ਟੈਗ ਲਾ ਦਿੰਦੇ ਵੀ ਤੂੰ ਅਨਪੜ੍ਹ ਆ ਅਰ ਦੁਕਾਨਾਂ ਦੇ ਵਿੱਚ ਤੁਸੀਂ ਬਾਜ਼ਾਰ ਦੇ ਵਿੱਚ ਚਲੇ ਜਾਉ ਜਿੰਨੇ ਵੀ ਬੋਰਡ ਆ ਦੁਕਾਨਾਂ ਦੇ ਜਿੰਨੇ ਵੀ ਬੋਰਡ ਆ ਸਾਰੇ ਹੀ ਇੰਗਲਿਸ਼ 'ਚ ਹੋਣਗੇ ਸਾਰੇ ਹੀ ਇੰਗਲਿਸ਼ 'ਚ ਹੋਣਗੇ ਜਿਹੜੇ ਆਪਣਾ ਆਪਣਾ ਅਖਬਾਰ ਦੇਖ ਲਉ ਅਖਬਾਰ ਲ ਲਗਭਗ ਜਿੰਨੇ ਵੀ ਉੇਰੇ ਮਾੜਾ ਮੋਟਾ ਜੇ ਕੋਈ ਬੰਦਾ ਪੜ੍ਹਿਆ ਲਿਖਿਆ ਹੈ ਉਹ ਪੰਜਾਬੀ ਦੇ ਅਖਬਾਰ ਨੂੰ ਪਹਿਲ ਨਹੀਂ ਕਰੇਗਾ ਉਹ ਕਹੇਗਾ ਮੇਰੇ ਘਰ ਇੰਗਲਿਸ਼ ਟ੍ਰਿਬਊਨ ਗਿਰੇ ਆ ਕੇ ਇੰਗਲਿਸ਼ ਨਿਊਜਪੇਪਰ ਕੋਈ ਵੀ ਹੋਵੇ ਇੰਗਲਿਸ਼ ਪੇਪਰ ਆਵੇ ਇਹ ਪਤਾ ਨਹੀਂ ਕਦ ਬੱਚਿਆਂ ਦੇ ਵਿੱਚ ਵੀ ਰੁਝਾਨ ਇਹ ਆ ਵੀ ਉਹ ਜੇ ਮਾਂ ਬਾਪ ਆਪਸ 'ਚ ਗੱਲ ਵੀ ਕਰਦੇ ਆ ਤਾਂ ਮਾਂ ਬਾਪ ਵੀ ਕਈ ਵਾਰ ਘੂਰਨ ਲੱਗ ਜਾਂਦੇ ਵੀ ਤੁਸੀਂ ਪੰਜਾਬੀ 'ਚ ਗੱਲ ਨਹੀਂ ਕਰਨੀ ਤੁਸੀਂ ਇੰਗਲਿਸ਼ 'ਚ ਗੱਲ ਕਰੋ ਤੁਸੀਂ ਇੰਗਲਿਸ਼ 'ਚ ਗੱਲ ਕਰੋ ਇਹਦੇ ਵਿੱਚ ਸਾਡੀ ਪੰਜਾਬੀ ਪ੍ਰਭਾਵਿਤ ਆ ਜਿਹੜੀ ਭਾਸ਼ਾ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਜਦਕਿ ਆਪਾਂ ਨੂੰ ਇਸ ਪ ਆਪਣਾ ਪੰਜਾਬੀ ਭਾਸ਼ਾ ਨੂੰ ਪਹਿਲ ਦੇਣੀ ਚਾਹੀਦੀ ਆ ਇਹ ਮਾਂ ਬੋਲੀ ਹੈ ਸਾਡੀ ਇਸਨੂੰ ਸਾਨੂੰ ਬਚਾ ਕੇ ਰੱਖਣਾ ਚਾਹੀਦਾ